ਮੇਰੇ ਕੋਲ ਸੁਣਾਈ ਸਿਲਾਈ ਬੁਣਾਈ ਦਾ ਕਾਫੀ ਸਮਾਨ ਹੈ ਜਿਵੇਂ ਕਿ ਸਿਲਾਈ ਦੀ ਮਸ਼ੀਨ ਹੈਗੀ ਆ ਕੈਂਚੀ ਵਗੈਰਾ ਥਰੈੱਡ ਵਗੈਰਾ ਸਾਰੇ ਹੈਗੇ ਨੇ ਪਰ ਫਿਰ ਵੀ ਮੈਨੂੰ ਕਈ ਕਿਤੇ ਨਾ ਕਿਤੇ ਲੱਗਦਾ ਹੈ ਵੀ ਅੱਜ ਦੀ ਜਿਹੜੀ ਨਿਊ ਟੈਕਨੋਲਜੀ ਆਈ ਜਾਂਦੀ ਮਸ਼ੀਨਸ ਆਈ ਜਾਂਦੀਆਂ ਜਿਵੇਂ ਪੈਰਾਂ ਵਾਲੀ ਮਸ਼ੀਨ ਹੈਗੀ ਆ ਮੈਨੂੰ ਚਾਹੀ ਲੱਗਦਾ ਆ ਵੀ ਮੈਨੂੰ ਮੋਟਰ ਵਾਲੀ ਮਸ਼ੀਨ ਲੈਣੀ ਚਾਹੀਦੀ ਹੈ ਜਿਵੇਂ ਜਿਵੇਂ ਨਿਊ ਟੈਕਨੋਲਜੀ ਆਈ ਜਾਂਦੀ ਹੈ ਮੈਨੂੰ ਲੱਗਦਾ ਹੈ ਵੀ ਉਸ ਹਿਸਾਬ ਦੇ ਨਾਲ ਮੈਨੂੰ ਆਪਣੀਆਂ ਚੀਜ਼ਾਂ ਨੂੰ ਖਰੀਦਣਾ ਚਾਹੀਦਾ ਆ ਬੁਣਾਈ ਲਈ ਮੇਰੇ ਕੋਲ ਉੱਨ ਹੈਗੀ ਆ ਸਿਲਾਈਆਂ ਹੈਗੀਆਂ ਨੇ ਪਰ ਫਿਰ ਵੀ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਜਿਵੇਂ ਨਵੀਆਂ ਨਵੀਆਂ ਉੱਨ ਆਈ ਜਾਂਦੀਆਂ ਉਵੇਂ ਉਹ ਖਰੀਦੀ ਜਾਵਾਂ ਮੈਨੂੰ ਬੜਾ ਚਾਅ ਰਹਿੰਦਾ ਹੈ ਵੀ ਹਰ ਇੱਕ ਚੀਜ਼ ਜਿਹੜੀ ਵੀ ਮੇਰੇ ਕੰਮ ਨਾਲ ਰਿਲੇਟਿਡ ਹੈਗੀ ਆ ਜਿਹੜਾ ਵੀ ਮੈਂ ਸਿਲਾਈ ਬੁਣਾਈ ਦਾ ਕੰਮ ਕਰਦੀ ਹਾਂ ਉਹਦੇ ਨਾਲ ਜਿਹੜਾ ਵੀ ਸਮਾਨ ਹੈਗਾ ਹੈ ਆ ਉਹ ਮੇਰੇ ਕੋਲ ਹੋਣ ਹੋਵੇ ਅਤੇ ਮੈਨੂੰ ਬਹੁਤ ਸ਼ੌਂਕ ਆ ਵੀ ਮੈਂ ਇਹ ਚੀਜ਼ਾਂ ਨੂੰ ਸਾਰਿਆਂ ਨੂੰ ਸਮਾਨ ਨੂੰ ਆਪਣੇ ਕੋਲ ਰੱਖਾਂ ਨਵਾਂ ਅਤੇ ਨਿੱਤ ਨਵੇਂ ਨਵੇਂ ਡਿਜ਼ਾਇਨ ਦੇਖਾਂ